ਬਹੁਤ ਹੀ ਵਧੀਆ ਹੈ ਕਿ ਮੈਂ ਆਪਣੇ ਦੋਸਤ ਮਿੱਤਰਾਂ ਤੋਂ ਲਿਖਣਾ ਬਹੁਤ ਪਸੰਦ ਉਹਨਾਂ ਦੀ ਕਿਤਾਬਾਂ 'ਤੇ ਲਿਖਣਾ ਬਹੁਤ ਪਸੰਦ ਕਰਦੀ ਹਾਂ ਪਰ ਉਹ ਉਹਨਾਂ ਦੀਆਂ ਕਿਤਾਬਾਂ ਵਿੱਚ ਕੋਈ ਵੀ ਸੇਧ ਦੁਆਰਾ ਮਤਲਬ ਗ੍ਰਾਫਿਕ ਦੁਆਰਾ ਨਹੀਂ ਲਿਖਿਆ ਗਿਆ ਹੈ ਇਹ 'ਚ ਇਸ ਲਈ ਮੈਨੂੰ ਮੇਰੀ ਰਾਇਟਿੰਗ ਭਾਵ ਮੈਨੂੰ ਲਿਖਣਾ ਬਹੁਤ ਪਸੰਦ ਹੈ ਇਸ ਲਈ ਮੈਂ ਆਪਣੀ ਸੁੰਦਰਤਾ ਤੇ ਬਹੁਤ ਮਾਣ ਕਰਦੀ ਹਾਂ ਅਤੇ ਜਿਸ ਵਿੱਚ ਮਤਲਬ ਹਰੇਕ ਅਹ ਸ਼ਬਦ ਨੂੰ ਸ ਸੇਧ ਕੇ ਮਤਲਬ ਉਹਨੂੰ ਪਰੋ ਕੇ ਇਹ 'ਚ ਵਧੀਆ ਢੰਗ ਨਾਲ ਲਿਖਿਆ ਜਾਂਦਾ ਹੈ ਅਤੇ ਇਸ ਮੈਨੂੰ ਆਪਣੀ ਲਿਖਣ ਦੀ ਪ੍ਰਕਿਰਿਆ 'ਤੇ ਬਹੁਤ ਮਾਣ ਹੈ ਇਸ ਲਈ ਲਿਖਣਾ ਹੀ ਪਸੰਦ ਕਰਾਂਗੀ ਨਾ ਕਿ ਸੇਧਣਾ ਮੈਨੂੰ ਸੇਧਣਾ ਬਿਲਕੁਲ ਵੀ ਪਸੰਦ ਨਹੀਂ ਹੈ ਇਸ ਲਈ ਮੈਂ ਲਿਖਣਾ ਸਭ ਤੋਂ ਵੱਧ ਪਸੰਦ ਕਰਦੀ ਹਾਂ ਲਿੱਖਣ ਮੇਰਾ ਲਿੱਖਣ ਵੇਲੇੇ ਮੈਂ ਆਪਣੇ ਦੋਸਤਾਂ ਮਿੱਤਰਾਂ ਦੀ ਸਲਾਹ ਲੈਂਦੀ ਹਾਂ ਅਤੇ ਨਾ ਜੋ ਕਿ ਆਪਣੀ ਮਤਲਬ ਕਠਿਨਾਈਆਂ ਮਤਲਵ ਗਲਤੀਆਂ ਹੋ ਗਈਆਂ ਦੱਸ ਸਕਦੇ ਹਨ ਤਾਂ ਕਿ ਮੈਂ ਸਹੀ ਢੰਗ ਨਾਲ ਉਹਨਾਂ ਨੂੰ ਬਿਆਨ ਕਰ ਸਕਦੀ ਹਾਂ ਇਸ ਲਈ ਮੈਨੂੰ ਜਿਸ ਵਧੀਆਂ ਢੰਗ ਨਾਲ ਸਭ ਨੂੰ ਬਿਆਨ ਕਰਕੇ ਆਪਣੀ ਬੁੱਕ ਜਾਂ ਆਪਾਂ ਕਾਫੀ ਵਿਚ ਲਿੱਖ ਸਕਦੇ ਹਾਂ ਅ ਜੋ ਕਿ ਆਪਣੇ ਮਨ ਪਸੰਦ ਦਾ ਗਾਂਹ ਡਯੂ ਮਿਊਜ਼ਿਕ ਜੋ ਵੀ ਵਿਆਹ ਮਤਲਵ ਕਹਾਣੀਆਂ ਦਾ ਜਿੱਦਾਂ ਵਾ ਉਹਨਾਂ ਨੂੰ ਬਿਆਨ ਕਰ ਸਕਦੀ ਹਾਂ ਵਧੀਆ ਤਰੀਕੇ ਨਾਲ ਜਿਸ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸਾਵਧਾਨ ਵਧੀਆ ਵਿਤਰਨ ਨਾਲ ਬਿਆਨ ਕਰਦੀ ਹਾਂ ਅਤੇ ਮੇਰੇ ਦੋਸਤ ਮਿੱਤਰ ਮੇਰੀ ਬਹੁਤ ਹੀ ਮਦਦ ਕਰਦੇ ਹਨ ਇਸ ਕੰਮ ਵਿੱਚ ਇਸ ਲਈ ਮੈਨੂੰ ਲਿੱਖਣਾ ਸਭ ਤੋਂ ਵੱਧ ਵਧੀਆ ਲੱਗਦਾ